ਹੈਲੋ ਹਾਂਜੀ ਮੈਂ ਨਾ ਇੱਕ ਆਪਣੀ ਕਾਰ ਵੇਚਣੀ ਸੀਗੀ ਅਤੇ ਉਹਦੀ ਮਾਲਕੀ ਅਤੇ ਤਬਦੀਲ ਬਦਲੀ ਕਰਵਾਉਣ ਵਾਸਤੇ ਪਹਿਲਾਂ ਉਹਦੇ ਵਾਸਤੇ ਮੈਂ ਪੀ ਯੂ ਸੀ ਸਰਟੀਫਿਕੇਟ ਦੀ ਜ਼ਰੂਰਤ ਹੈਗੀ ਹੈ ਅਤੇ ਉਹਦੇ ਬਾਰੇ ਅਰਜ਼ੀ ਜਿਹੜੀ ਹੈ ਉਹ ਦੇਣੀ ਆ ਉਹਦੇ ਵਾਸਤੇ ਮੈਨੂੰ ਨਾ ਥੋੜ੍ਹੀ ਜਿਹੀ ਤੁਹਾਡੀ ਹੈਲਪ ਦੀ ਜ਼ਰੂਰਤ ਹੈਗੀ ਹੈ ਅਤੇ ਉਹ ਮੈਨੂੰ ਤੁਸੀਂ ਦੱਸ ਸਕਦੇ ਹੋ ਵੀ ਉਹਦੇ ਵਾਸਤੇ ਕੀ ਕੀ ਚਾਹੀਦਾ ਅਧ ਜਿਵੇਂ ਕਿ ਆਧਾਰ ਕਾਰਡ ਤਾਂ ਚਾਹੀਦਾ ਹੀ ਹੋਏਗਾ ਆਧਾਰ ਕਾਰਡ ਆਰ ਸੀ ਅਤੇ ਹੋਰ ਕੀ ਹੁੰਦਾ

ਹਾਂਜੀ ਹਾਂਜੇ ਅਤੇ ਉਹਦੀ ਟਾਈਮਿੰਗ ਕੀ ਹੈ ਵੀ ਉਹਨੂੰ ਦੇਣ ਵਾਸਤੇ ਆਨਲਾਈਨ ਕਰ ਸਕਦੇ ਹਾਂ ਟਾਈਮਿੰਗ ਦਫਤਰ ਦੀ ਕੀ ਹੋਏਗੀ ਠੀਕ ਹੈ ਅਤੇ ਇਹ ਜਲਦੀ ਪ੍ਰਕਿਰਿਆ ਆਪਾਂ ਕਰਨੀ ਸੀਗੀ ਕੰਪਲੀਟ ਕਰਨਾ ਵਚ ਜਲਦੀ ਵੇਚਣੀ ਹੈਗੀ ਕਾਰ ਅਤੇ ਉਹਦੇ ਵਾਸਤੇ ਤੁਸੀਂ ਕੀ ਹੈਲਪ ਕਰੋਗੇ ਹੈਲਪ ਕਰ ਸਕਦੇ ਹੋ ਜਲਦੀ ਵੀ ਕੋਈ ਕੋਈ ਸਜੈਸਟ ਕਰੋ ਤਰੀਕਾ ਠੀਕ ਹੈ ਹਾਂਜੀ ਅੱਛਾ ਠੀਕ ਹੈ ਠੀਕ ਹੈ ਅੱਛਾ ਜੀ ਕਿੰਨੇ ਤਿੰਨ ਚਾਰ ਦਿਨਾਂ ਵਿੱਚ ਹੋਏਗਾ ਕੰਪਲੀਟ ਧੰਨਿਆਵਾਦ ਜੀ